ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਅੰਮ੍ਰਿਤ ਮੈਡਮ ਗੱਲ ਕਰ ਰਹੇ ਹੋ ਜੀ ਹਾਂਜੀ ਮੈਮ ਮੈਂ ਤੁਹਾਡੇ ਕਲੋਨੀ ਦੇ ਵਿੱਚ ਨਿਊ ਰੈਜੀਡੈਂਸ ਹਾਂ ਜੀ ਹਾਂਜੀ ਮੈਨੂੰ ਕੁਛ ਡੈਅਰੀ ਨਾਲ ਸੰਬੰਧਿਤ ਕੋਈ ਪ੍ਰੋਡਕਟ ਚਾਹੀਦੇ ਨੇ ਅਸੀਂ ਕੋਈ ਤੁਹਾਡੇ ਨੀਅਰਸਟ ਹੈ ਜੀ ਕੋਈ ਡੈਅਰੀ ਅੱਛਾ ਜੀ ਓ ਓਕੇ ਜੀ ਆਪਣੇ ਘਰ ਤੋਂ ਕਿੰਨੀ ਦੂਰੀ 'ਤੇ ਹੈ ਮੈਮ ਓਕੇ ਜੀ ਕੀ ਕੀ ਪ੍ਰੋਜ ਪ੍ਰੋਡਕਟ ਮਿਲ ਜਾਣਗੇ ਜੀ ਉੱਥੋਂ ਅੱਛਾ ਜੀ ਓਕੇ ਜੀ ਤੁਸੀਂ ਘਰ ਯੂਜ ਕਰਦੇ ਜੀ ਉਹਨਾਂ ਦੇ ਪ੍ਰੋਡਕਟ ਜੀ ਓਕੇ ਜੀ ਹਾਂਜੀ ਮੈਮ ਆਪਾਂ ਨੂੰ ਦੁੱਧ ਦਹੀਂ ਲੱਸੀ ਵੈਸੇ ਪ੍ਰੋਡਕਟ ਜਿਹੜੇ ਘਰਾਂ ਦੇ ਯੂਜ ਹੁੰਦੇ ਆ ਉਹ ਸਾਰੇ ਚਾਹੀਦੇ ਨੇ ਜੀ ਹਾਂਜੀ ਅਤੇ ਇਹਨਾਂ ਦੀ ਟਾਈਮਿੰਗ ਕੀ ਹੈ ਅਤੇ ਪ੍ਰਾਈਜ ਵਗੈਰਾ ਕੀ ਹੈ ਜੀ ਸਵੇਰੇ ਮ ਮੋਰਨਿੰਗ ਕਿਸ ਟਾਈਮ ਖੁੱਲ੍ਹਦੀ ਜੀ ਅੱਛਾ ਜੀ ਚਲੋ ਈਵਨਿੰਗ ਟਾਈਮ ਮੈਮ ਸਾਨੂੰ ਪ੍ਰੋਡਕਟ ਚਾਹੀਦੇ ਨੇ ਅਤੇ ਅਗਰ ਤੁਹਾਡਾ ਸਮਾਂ ਹੋਵੇਗਾ ਤਾਂ ਤੁਸੀਂ ਸਾਡੇ ਨਾਲ ਜਾ ਸਕਦੇ ਜੀ ਪ੍ਰੋਡਕਟ ਲੈਣ ਵਾਸਤੇ ਅਤੇ ਉਹ ਹਾਰਡ ਕੈਸ਼ ਪੇਮੈਂਟ ਲੈਂਦੇ ਨਾ ਜੀ ਜਾਂ ਔਨਲਾਈਨ ਜੀ ਅੱਛਾ ਜੀ ਚਲੋ ਠੀਕ ਹੈ ਮੈਮ ਮੈਂ ਕੱਲ੍ਹ ਤੁਹਾਨੂੰ ਕੋਲ ਕਰਾਂਗਾ ਅਤੇ ਜਦੋਂ ਅਸੀਂ ਪ੍ਰੋਡਕਟ ਲੈਣਾ ਤਾਂ ਤੁਸੀਂ ਸ ਪਲੀਜ਼ ਸਾਡੇ ਨਾਲ ਚੱਲ ਪਉਂਗੇ ਜੀ ਚਲੋ ਠੀਕ ਹੈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ